ਸਾਡੇ ਖੇਤਰ ਦੇ ਵਿੱਚ ਬਹੁਤ ਹੀ ਟਰਾਂਸਪੋਰਟਾਂ ਦੀਆਂ ਸਹੂਲਤਾਂ ਮਿਲ ਚੁੱਕੀਆਂ ਨੇ ਜਿਵੇਂ ਓਲਾ ਕੈਬ ਓਲਾ ਕੈਬ ਬੱਸਾਂ ਈ ਰਿਕਸ਼ਾ ਓਟੋ ਦੂਸਰੀ ਰਿਕਸ਼ਾ ਕਈ ਤਰ੍ਹਾਂ ਦੇ ਮਤਲਬ ਕਿ ਟਰਾਂਸਪੋਰਟ ਨੇ ਮਤਲਬ ਕਿ ਜਿਵੇਂ ਸਟੇਸ਼ਨ ਤੋਂ ਨਿਕਲੋ ਅਤੇ ਈ ਰਿਕਸ਼ਾ ਵੀ ਕਾਫ਼ੀ ਮਿਲ ਜਾਂਦੀਆਂ ਨੇ ਉਹ ਬੱਸ ਸਟੈਂਡ ਤੋਂ ਉਤਰੋ ਤਾਂ ਓਟੋਆਂ ਦੀ ਲਾਇਨ ਲੱਗੀ ਹੁੰਦੀ ਹੈ ਕੋਈ ਕਿਰਾਇਆ ਵੀ ਆਮ ਆਮ ਹੀ ਕਿਰਾਇਆ ਹੁੰਦਾ ਹੈ ਬਹੁਤ ਜ਼ਿਆਦਾ ਨਹੀਂ ਹੁੰਦਾ ਲੇਡੀਜ਼ ਵਾਸਤੇ ਤਾਂ ਉਹਨਾਂ ਨੇ ਸਰਕਾਰੀ ਬੱਸਾਂ ਵੀ ਪ੍ਰੋਵਾਈਡ ਕਰ ਦਿੱਤੀਆਂ ਨੇ ਜਿਹਦੇ ਵਿੱਚ ਲੇਡੀਜ਼ ਦਾ ਆਧਾਰ ਕਾਰਡ ਦੇ ਉੱਤੇ ਫਰੀ ਹੀ ਫਰੀ ਆਫ ਕੋਸਟ ਹੈ ਫਰੀ ਹੀ ਜਾ ਸਕਦੀਆਂ ਨੇ ਉਹਨਾਂ ਦਾ ਕੋਈ ਪੈਸਾ ਰੁਪਇਆ ਨਹੀਂ ਲੱਗਦਾ ਅਤੇ ਉੱਦਾਂ ਈ ਰਿਕਸ਼ਾ ਵੀ ਬਹੁਤ ਵਧੀਆ ਨੇ ਉਹ ਵੀ ਪਰ ਸਵਾਰੀ ਦੇ ਹਿਸਾਬ ਨਾਲ ਜਾਂਦੇ ਕਈ ਤਰ੍ਹਾਂ ਦੇ ਟਰਾਂਸਪੋਰਟ ਨੇ ਮੰਨ ਲਓ ਕਿ ਜਿਵੇਂ ਅਸੀਂ ਕੋਈ ਬਾਹਰੋਂ ਆਇਆ ਹੈ ਜਾਂ ਕਿਤੋਂ ਫੋਰਨ ਤੋਂ ਆਇਆ ਏਅਰਪੋਰਟ ਤੋਂ ਵੀ ਸਿੱਧੀ ਸਾਨੂੰ ਈ ਰਿਕਸ਼ਾ ਓਟੋ ਜਾਂ ਬੱਸ ਵੀ ਮਿਲ ਜਾਂਦੀਆਂ ਨੇ ਲੋਕਲ ਬੱਸਾਂ ਵੀ ਮਿਲ ਜਾਂਦੀਆਂ ਨੇ ਤਾਂ ਓਟੋ ਵਾਲਿਆਂ ਦੇ ਨਾਲ ਤੁਸੀਂ ਗੱਲ ਕਰਕੇ ਤੁਹਾਨੂੰ ਇੱਥੇ ਬਹੁਤ ਸੋਹਣੀਆਂ ਚੀਜ਼ਾਂ ਵਿਖਾ ਦਿੰਦੇ ਨੇ ਟ੍ਰਾਂਸਪੋਰਟ ਵਾਲੇ ਹੀ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਕਿ ਤੁਸੀਂ ਕਿੱਥੋਂ ਖਰੀਦਾ ਪੁਸ਼ੀ ਕਰਨੀ ਹੈ ਕਿਹੜੇ ਬਾਜ਼ਾਰ ਜਾਣਾ ਹੈ ਉਹ ਟਰਾਂਸਪੋਰਟ ਵਾਲੇ ਤੁਹਾਨੂੰ ਖੁਦ ਹੀ ਲੈ ਜਾਂਦੇ ਨੇ ਸਾਨੂੰ ਕਦੇ ਵੀ ਦਿੱਕਤ ਨਹੀਂ ਆਉਂਦੀ ਸਾਡੇ ਸ਼ਹਿਰ ਦੇ ਖੇਤਰ ਦੇ ਵਿੱਚ ਕਦੇ ਵੀ ਇਹ ਪ੍ਰੋਬ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿ ਸਾਨੂੰ ਸੁੱਖ ਸਹੂਲਤ ਨਹੀਂ ਹਰ ਜਗ੍ਹਾ 'ਤੇ ਹਰ ਕਦਮ ਦੇ ਉੱਤੇ ਹੀ ਟਰਾਂਸਪੋਰਟ ਹੈ ਚਾਹੇ ਤੁਸੀਂ ਗੱਡੀ ਕਰੋ ਚਾਹੇ ਤੁਸੀਂ ਸਕੂਟਰ ਕਰੋ ਜਾਂ ਕੁਛ ਵੀ ਫੋਨ ਕਰੋ ਉਹਨੂੰ ਡਾਊਨਲੋਡ ਐਪ ਐਪ ਡਾਊਨਲੋਡ ਕਰਕੇ ਤੁਸੀਂ ਕਿਤੇ ਵੀ ਆਰਾਮ ਨਾਲ ਆਸਾਨੀ ਨਾਲ ਜਾ ਸਕਦੇ ਹੋ ਚਾਹੇ ਕੋਈ ਸਿਆਣਾ ਹੈ ਜਾਂ ਕੋਈ ਜਵਾਨ ਬੱਚਾ ਜਾਂ ਕੁਛ ਵੀ ਹੈ ਸਾਨੂੰ ਕੋਈ ਮੁਸ਼ਕਿਲ ਪਰੇਸ਼ਾਨੀ ਨਹੀਂ ਆਉਂਦੀ